ਸਾਈਕਲ ਚਲਾਉਣਾ ਹੈ ਜਿਹੜਾ ਇਹ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਇਹਦੇ ਨਾਲ ਇੱਕ ਤਾਂ ਆਪਣਾ ਹੈਗਾ ਜਿਹੜਾ ਹੈਗਾ ਆਪਣੀ ਜਿਹੜੀ ਸਿਹਤ ਹੈਗੀ ਉਹ ਵਧੀਆ ਰਹਿੰਦੀ ਹੈਗੀ ਆ ਅਤੇ ਇੱਕ ਰੂਟੀਨ ਦੀ ਇਹ ਐਕਸਰਸਾਈਜ਼ ਹੈਗੀ ਹੈ ਠੀਕ ਹੈ ਜੇ ਆਪਾਂ ਰੂਟੀਨ 'ਚ ਇਹਨੂੰ ਚਲਾਉਂਦੇ ਹੈਗੇ ਤਾਂ ਫਿਰ ਆਪਾਂ ਨੂੰ ਇਹਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਅਤੇ ਧਿਆਨ ਰੱਖਣ ਲਈ ਆਪਾਂ ਨੂੰ ਇਹਦੀ ਸਾਫ ਸਫਾਈ ਇਹਦੇ ਬਰੇਕ ਚੇਨ ਸਾਰਾ ਕੁਛ ਵਧੀਆ ਤਰੀਕੇ ਦੇ ਨਾਲ ਦੇਖਣਾ ਚਾਹੀਦਾ ਹੈ ਠੀਕ ਹੈ ਅਤੇ ਫਿਰ ਇਹਦੇ ਵਿੱਚ ਆਪਾਂ ਨੂੰ ਮਤਲਬ ਇੱਕ ਤਾਂ ਜਿਹੜਾ ਹੈਗਾ ਸਵੇਰੇ ਆਪਾਂ ਮੋਰਨਿੰਗ ਵਾਕ ਕਰਦੇ ਹਾਂ ਉਹਦੇ ਸਾਈਕਲਿੰਗ ਵੀ ਕਰ ਸਕਦੇ ਹੈਗੇ ਜਦੋਂ ਆਪਾਂ ਸਾਈਕਲਿੰਗ ਕਰਦੇ ਹਾਂ ਤਾਂ ਆਪਣਾ ਇਹਦੇ ਨਾਲ ਸਰੀਰ ਵੀ ਸਹੀ ਰਹਿੰਦਾ ਹੈਗਾ ਅਤੇ ਆਪਾਂ ਜਿਹੜਾ ਹੈਗਾ ਗਾ ਆਪਣਾ ਪੇਟ ਘਟਦਾ ਹੈਗਾ ਗਾ ਅਤੇ ਆਪਣੇ ਜਿਹੜੀ ਹੈਗੀ ਰੂਟੀਨ 'ਚ ਸਾਈਕਲਿੰਗ ਕਰਨ ਵਾਲਾ ਆਪਣਾ ਜਿਹੜਾ ਹੈਗਾ ਵਧੀਆ ਰਹਿੰਦਾ ਹੈਗਾ ਸਰੀਰ ਸਿਹਤ ਤੰਦਰੁਸਤ ਰਹਿੰਦੀ ਹੈਗੀ ਆਪਾਂ ਜਿਹੜਾ ਆਉਣਾ ਜਾਣਾ ਹੈਗਾ ਗਾ ਅਗਰ ਆਪਾਂ ਸਾਇਕਲਿੰਗ ਕਰਦੇ ਹੈਗੇ ਹਾਂ ਤਾਂ ਆਪਾਂ ਪੂਰੇ ਪਰਫੈਕਟ ਰਹਿੰਦੇ ਹੈਗੇ ਐਗੇ ਪੂਰੇ ਸਹੀ ਤੰਦਰੁਸਤ ਰਹਿੰਦੇ ਹਾਂ ਜੇ ਕਿਤੇ ਆਪਾਂ ਥੋੜ੍ਹੀ ਦੂਰ ਤੱਕ ਵੀ ਜਾਣਾ ਹੈਗਾ ਅਤੇ ਆਪਾਂ ਉਹ ਜਿਹੜਾ ਹੈਗਾ ਜਾਣ ਆਉਣ ਹੈਗਾ ਉਹ ਵਧੀਆ ਕਰ ਸਕਦੇ ਹਾਂ ਬਿਨਾਂ ਖਰਚੇ ਤੋਂ ਘੱਟ ਖਰਚੇ 'ਤੇ ਅਤੇ ਆਪਣਾ ਸਰੀਰ ਵੀ ਵਧੀਆ ਰਹਿੰਦਾ ਹੈ ਅਤੇ ਆਪਣਾ ਹੈਗਾ ਜਿਹੜਾ ਵੇਟ ਘਟਦਾ ਹੈ ਆਪਣਾ ਭਾਰ ਘਟਦਾ ਹੈ ਜਿਹੜੀਆਂ ਛੋਟੀਆਂ ਛੋਟੀਆਂ ਬਿਮਾਰੀਆਂ ਹਨ ਸ਼ੂਗਰ ਵੀ ਜਿਹਦਾ ਸਾਰਾ ਕੁਛ ਘਟ ਜਾਂਦਾ